ਮੇਰੇ ਇਲਾਕੇ ਦੇ ਵਿੱਚ ਕਈ ਸਰਕਾਰੀ ਸਕੂਲ ਪ੍ਰਸਿੱਧ ਨੇ ਕਈ ਪ੍ਰਾਈਵੇਟ ਸਕੂਲ ਪ੍ਰਸਿੱਧ ਨੇ ਉਹਨਾਂ ਦੇ ਵਿੱਚ ਇਹੀ ਆ ਵੀ ਉਹਨਾਂ ਦੀ ਵਿਸ਼ੇਸ਼ਤਾਵਾਂ ਇਹ ਨੇ ਕਿ ਵੀ ਉਥੇ ਬੱਚੇ ਪੜ੍ਹਦੇ ਨੇ ਉੱਥੇ ਕਾਫੀ ਬੱਚੇ ਪੜ੍ਹਦੇ ਨੇਗੇ ਅਤੇ ਹੈ ਨਾ ਨਾਲੇ ਉਥੇ ਸਾਰਾ ਸਟਾਫ ਵੀ ਪੂਰਾ ਆ ਮਤਲਬ ਜਿੰਨੇ ਟੀਚਰਸ ਹੋਣੇ ਚਾਹੀਦੇ ਨੇ ਸਕੂਲ ਦੇ ਵਿੱਚ ਓਨੇ ਹੈਗੇ ਨੇ ਬਟ ਮੈਂ ਉਹਨਾਂ ਦੀ ਸਿੱਖਿਆ ਤੋਂ ਸੰਤੁਸ਼ਟ ਨਹੀਂ ਹਾਂ ਮੈਨੂੰ ਲੱਗਦਾ ਆ ਲੱਗਦਾ ਕਿ ਇਸ ਇਹ ਗੱਲ ਹੈਗੀ ਆ ਵੀ ਹਾਂ ਮੈਂ ਪ ਪਿਛਲੇ ਪੰਜ ਸਾਲਾਂ ਤੋਂ ਦੇਖ ਰਹੀ ਹਾਂ ਉਹਨਾਂ ਸਕੂਲਾਂ ਬਾਰੇ ਪੜ੍ਹ ਰਹੀ ਹਾਂ ਦੇਖ ਰਹੀ ਹਾਂ ਸੁਣ ਰਹੀ ਹਾਂ ਅਤੇ ਉਹਨਾਂ ਦੇ ਬੱਚਿਆਂ ਨਾਲ ਵੀ ਗੱਲਬਾਤ ਕਰ ਰਹੀ ਹਾਂ ਉੱਥੋਂ ਮੈਨੂੰ ਇਹੀ ਪਤਾ ਲੱਗਦਾ ਹੈਗਾ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਸਿਰਫ ਤਨਖਾਹਾਂ ਲੈਣ ਲਈ ਹੀ ਸਕੂਲਾਂ ਵਿੱਚ ਆਉਂਦੇ ਨੇਗੇ ਬੈਠਦੇ ਨੇ ਪੜਾਉਂਦੇ ਨੇ ਪਤਾ ਨਹੀਂ ਪੜਾਉਂਦੇ ਨੇ ਪਤਾ ਨਹੀਂ ਨਹੀਂ ਪੜਾਉਂਦੇ ਜੇ ਪੜਾਉਂਦੇ ਹੁੰਦੇ ਤਾਂ ਬੱਚਿਆਂ ਨੂੰ ਸਾਰੀ ਉਹਨਾਂ ਦੀ ਜਿਹੜੀ ਬੇਸਿਕ ਕੋਨਸੈਪਟ ਹੁੰਦੇ ਨੇਗੇ ਉਹ ਸਾਰੇ ਕਲੀਅਰ ਹੋਣੇ ਸੀ ਬਟ ਮੈਨੂੰ ਨਹੀਂ ਲੱਗਦਾ ਵੀ ਉੱਥੇ ਪੜ੍ਹਾਇਆ ਜਾਂਦਾ ਹੈਗਾ ਇਸ ਲਈ ਮੈਂ ਵੱਡੇ ਸ਼ਹਿਰਾਂ ਦੇ ਸਕੂਲਾਂ ਨੂੰ ਤਰਜੀਹ ਦਿੰਦੀ ਹਾਂ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਆ ਵੀ ਹਾਂ ਉਹ ਵਧੀਆ ਤਰੀਕੇ ਨਾਲ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਂਦੇ ਨੇਗੇ ਵਧੀਆ ਤਰੀਕੇ ਨਾਲ ਮੈਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਵੀ ਗੱਲਬਾਤ ਕਰਦੀ ਹਾਂ ਅਤੇ ਮਤਲਬ ਥੋੜ੍ਹੇ ਕੁ ਟਾਈਮ ਬਾਅਦ ਮੇਰੀ ਇਹ ਆਦਤ ਆ ਵੀ ਮੈਂ ਬੱਚਿਆਂ ਬਾਰੇ ਥੋੜ੍ਹੀ ਨੋਲੇਜ ਰੱਖਦੀ ਹਾਂ ਵੀ ਹਾਂ ਉਹ ਉਹ ਵਾਲੇ ਸਕੂਲ ਦੇ ਵਿੱਚ ਕਿਹੜਾ ਬੱਚਾ ਕਿਵੇਂ ਪੜ੍ਹਦਾ ਆ ਉਸ ਸਕੂਲ ਦੇ ਵਿੱਚ ਕੀ ਕਰਵਾਇਆ ਜਾਂਦਾ ਆ ਜਦੋਂ ਮੈਂ ਦੋਨਾਂ ਸਕੂਲਸ ਨੂੰ ਕੰਪੇਅਰ ਕਰਦੀ ਹਾਂ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਸਕੂਲ ਨੇ ਅਤੇ ਉਹ ਵਾਲੇ ਸ ਪ੍ਰਾਈਵੇਟ ਸਕੂਲਾਂ ਨੂੰ ਜਦੋਂ ਮੈਂ ਕੰਪੇਅਰ ਕਰਦੀ ਹਾਂ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਨਰਸਰੀ ਕਜੀ ਕੇ ਜੀ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਨਰਸਰੀ ਕੇ ਜੀ ਦੇ ਬੱਚੇ ਹੁੰਦੇ ਆ ਨਾ ਜਿਹੜੇ ਉਹਨਾਂ ਨੂੰ ਵੀ ਇਹ ਪਤਾ ਹੁੰਦਾ ਵੀ ਹਾਂ ਬੱਚਾ ਕੀ ਕਰ ਰਿਹਾ ਆ ਉਹਨਾਂ ਨੂੰ ਸਾਰਾ ਕੁਛ ਪਤਾ ਹੋਇਆ ਹੁੰਦਾ ਆ ਇੰਟਰੋਡਕਸ਼ਨ ਇੰਗਲਿਸ਼ ਦੇ ਵਿੱਚ ਆਉਂਦੀ ਹੁੰਦੀ ਆ ਅਤੇ ਉਹਨਾਂ ਨੂੰ ਨੌਲੇਜ ਹੁੰਦੀ ਆ ਵੀ ਹਾਂ ਅਸੀਂ ਇਸ ਕੰਮ ਨੂੰ ਇਸ ਤਰੀਕੇ ਨਾਲ ਕਰਨਾ ਆ ਅਤੇ ਉਹੀ ਮੈਂ ਜੇ ਗੱਲ ਦੇਖਾਂ ਉਹਨਾਂ ਨੂੰ ਮੈਨਰਸ ਹੁੰਦੇ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਨੂੰ ਮੈਨਰਜ ਹੁੰਦੇ ਨੇ ਵੀ ਅਸੀਂ ਕਿਸ ਤਰ੍ਹਾਂ ਬੈਠਣਾ ਉੱਠਣਾ ਆ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਸਾਰੇ ਟੀਚਰਸ ਨੇ ਉਹ ਪ੍ਰਾਈਵੇਟ ਹੁੰਦੇ ਨੇ ਅਤੇ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਤਨਖਾਹ ਮਿਲੇਗੀ ਅਗਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਸਾਨੂੰ ਕੋਈ ਤਨਖਾਹਾਂ ਨਹੀਂ ਦੇਣ ਲੱਗੇ ਪ੍ਰਿੰਸੀਪਲਸ ਹੁੰਦੇ ਨੇ ਜਿਹੜੇ ਇਸ ਲਈ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਸ ਦੇ ਮੇਨ ਮੋਟਿਵ ਤਾਂ ਇਹੀ ਹੁੰਦਾ ਆ ਬਸ ਵੀ ਤਨਖਾਹ ਪੈਂਦੀ ਹੈ ਚਲੋ ਕੋਈ ਨਹੀਂ ਠੀਕ ਆ ਬਸ ਬੱਚੇ ਪੜ੍ਹਨ ਨਾ ਪੜ੍ਹਨ ਉਹਨਾਂ ਤੱਕ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਨਾਈਨਟੀ ਪ੍ਰਸੈਂ ਪ੍ਰਸੈਂਟ ਆ ਜਿਹੜਾ ਸਟਾਫ ਆ ਸਰਕਾਰੀ ਸਕੂਲਾਂ ਦਾ ਉਹ ਐਵੇਂ ਦਾ ਹੀ ਆ ਜਿਹੜਾ ਸੋਚ ਕੇ ਜਾਂਦਾ ਵੀ ਚਲੋ ਕੋਈ ਨਹੀਂ ਤਨਖਾਹ ਪੈ ਜੂਗੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਹੁੰਦਾ ਵੀ ਟੀਚਰ ਦੇ ਉੱਪਰ ਜ਼ਿੰਮੇਵਾਰੀਆਂ ਹੁੰਦੀਆਂ ਵੀ ਹਾਂ ਅਸੀਂ ਇਹ ਪੜ੍ਹਾਵਾਂਗੇ ਤਾਂ ਸਾਨੂੰ ਸੈਲਰੀ ਪਊਗੀ ਬੱਚਾ ਐਨਾ ਕਾਬਲ ਹੋਣਾ ਚਾਹੀਦਾ ਹੈਗਾ ਮੈਂ ਜਦੋਂ ਕੰਪੇਅਰ ਕਰਦੀ ਹਾਂ ਦੋਨਾਂ ਸਕੂਲ ਨੂੰ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੈਂ ਦੇਖਦੀ ਹਾਂ ਵੀ ਬਹੁਤ ਫਰਕ ਆ ਸਰਕਾਰੀ ਸਕੂਲ ਦੇ ਬੱਚੇ ਨੇ ਜਿਹੜੇ ਉਹ ਆਪਣੇ ਆਪ ਬਾਰੇ ਖੁੱਲ੍ਹ ਕੇ ਦੱਸ ਵੀ ਨਹੀਂ ਸਕਦੇ ਕਿਸੇ ਨੂੰ ਅਤੇ ਸ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੁੰਦੇ ਨੇ ਉਹ ਪ੍ਰੋਪਰ ਤਰੀਕੇ ਨਾਲ ਇੰਟਰੋਡਕਸ਼ਨ ਦਿੰਦੇ ਨੇਗੇ ਆਪਣੀ ਵੀ ਮੇ ਮਾਈ ਨੇਮ ਇਜ਼ ਮਾਈਸੈਲਫ ਮਤਲਬ ਪ੍ਰੋਪਰ ਤਰੀਕੇ ਨਾਲ ਦਿੰਦੇ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਲਰਸ ਨੇਮ ਨਹੀਂ ਪਤਾ ਹੈਗੇ ਫਿਫਥ ਕਲਾਸ ਤੱਕ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਤੱਕ ਨਹੀਂ ਆਉਂਦੀ ਐਨਾ ਬੁਰਾ ਹਾਲ ਆ ਅਤੇ ਸਰਕਾਰ ਆ ਜਿਹੜੀ ਉਹ ਉਹਨਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਪ੍ਰਿੰਸੀਪਲਸ ਨੇ ਸਾਰੇ ਇਹ ਧਿਆਨ ਦਿੰਦੇ ਨੇ ਵੀ ਹਾਂ ਅਸੀਂ ਆਪਣਾ ਵਧੀਆ ਸਟਾਫ ਰੱਖੀਏ ਇਹੋ ਜਿਹਾ ਸਟਾਫ ਰੱਖੀਏ ਤਾਂ ਜੋ ਬੱਚਿਆਂ ਨੂੰ ਕਾਬਲ ਬਣਾ ਸਕੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਪੇਪਰ ਕਲੀਅਰ ਕੀਤਾ ਪੇਪਰ ਕਲੀਅਰ ਕਿਵੇਂ ਕਰਦੇ ਆ ਸਾਰਾ ਕੁਛ ਸਿਫਾਰਸ਼ਾਂ 'ਤੇ ਹੀ ਚੱਲਦਾ ਹੈਗਾ ਬਿਨਾਂ ਸਿਫਾਰਸ਼ ਤੋਂ ਕੋਈ ਪੇਪਰ ਕਲੀਅਰ ਹੁੰਦਾ ਹੀ ਨੀਗਾ ਜੇ ਬਿਨਾਂ ਸਿਫਾਰਿਸ਼ ਤੋਂ ਹੁੰਦਾ ਤਾਂ ਜਿਹੜੇ ਬੱਚੇ ਇੰਟੈਲੀਜੈਂਟ ਨੇ ਉਹ ਆਪਣਾ ਪੇਪਰ ਕਰੈਕ ਕਰ ਸਕਦੇ ਸੀ ਜਿਹੜੇ ਬਹੁਤ ਜ਼ਿਆਦਾ ਵਧੀਆ ਨੇਗੇ ਉਹ ਤਾਂ ਚਲੋ ਕਰੀ ਲੈਂਦੇ ਨੇ ਜਿਹੜੇ ਹੁੰਦੇ ਨੇ ਵੀ ਹਾਂ ਵਧੀਆ ਪੜ੍ਹਦੇ ਨੇ ਵਧੀਆ ਉਹਨਾਂ ਵਿੱਚ ਜੋਸ਼ ਹੁੰਦਾ ਜਨੂੰਨ ਹੁੰਦਾ ਹੈਗਾ ਉਸ ਚੀਜ਼ ਨੂੰ ਕਰਨ ਦਾ ਉਹ ਨਹੀਂ ਕਰ ਪਾਉਂਦੇ ਹੈਗੇ ਉਹ ਬੇਰੁਜ਼ਗਾਰੀ ਕਰਕੇ ਬੇਰੁਜ਼ਗਾਰੀ ਉਹਨਾਂ ਕਾਰਨਾਂ ਕਰਕੇ ਆ ਵੀ ਹਾਂ ਬੱਚੇ ਵਧੀਆ ਵੀ ਨੇ ਪਰ ਫੇਰ ਵੀ ਉਹ ਪੇਪਰਾਂ ਦੇ ਵਿੱਚ ਜਿਹੜੇ ਅ ਸਿਫਾਰਸ਼ਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਕਲੀਅਰ ਹੁੰਦੇ ਨੇ ਸਾਰਾ ਕੁਛ ਚਲੋ ਜੀ ਠੀਕ ਹੈ